ਹੈਲੋ ਸੇਤੀਆ ਰੈਸਟੋਰੈਂਟ ਤੋਂ ਬੋਲਦੇ ਹੋ ਅਸੀਂ ਤੁਹਾਡੇ ਤੋਂ ਕੱਲ੍ਹ ਖਾਣਾ ਮੰਗਵਾਇਆ ਸੀ ਉਹ ਖਾਣਾ ਸਾਡਾ ਸਹੀ ਨਹੀਂ ਮਿਲਿਆ ਗਾ ਸਾਡੇ ਘਰ ਪਾਰਟੀ ਸੀ ਤੁਸੀਂ ਤਾਂ ਸਾਡੀ ਬੇਇੱਜ਼ਤੀ ਕਰਵਾ ਦਿੱਤੀ ਨਾਲੇ ਤਾਂ ਬਿਮਾਰ ਹੋਏ ਖਾ ਕੇ ਨਾਲੇ ਕਿਸੇ ਨੂੰ ਵੀ ਪਸੰਦ ਨਹੀਂ ਆਇਆ ਅਸੀਂ ਤਾਂ ਤੁਹਾਡੀ ਬਹੁਤ ਤਰੀਫ਼ ਸੁਣੀ ਸੀ ਇਸੇ ਕਰਕੇ ਹੀ ਤਾਂ ਅਸੀਂ ਤੁਹਾਡੇ ਤੋਂ ਮੰਗਾਇਆ ਸੀ ਤੁਹਾਡੇ ਖਾਣੇ ਦੇ ਵਿੱਚ ਮਸਾਲੇ ਹੀ ਮਸਾਲੇ ਸੀ ਕੋਈ ਟੇਸਟ ਨਹੀਂ ਸੀ ਇੰਨਾ ਬੇਕਾਰ ਸੀ ਅਸੀਂ ਤਾਂ ਅੱਗੇ ਤੋਂ ਸੋਚਦੇ ਸੀ ਵੀ ਅਸੀਂ ਹੋਰ ਵੀ ਜ਼ਿਆਦਾ ਮੰਗਵਾਇਆ ਕਰਾਂਗੇ ਪਰ ਤੁਸੀਂ ਤਾਂ ਸਾਡਾ ਪਹਿਲੀ ਵਾਰ 'ਚ ਹੀ ਕੰਮ ਖਰਾਬ ਕਰਤਾ ਇਸ ਕਰਕੇ ਅਸੀਂ ਤਾਂ ਹੋਰ ਵੀ ਲੋਕਾਂ ਨੂੰ ਕਹਾਂਗੇ ਕਿ ਵੀ ਇਸ ਰੈਸਟੋਰੈਂਟ ਤੋਂ ਕਦੇ ਵੀ ਕੋਈ ਖਾਣਾ ਨਾ ਮੰਗਵਾਓ ਵੀ ਕਿਸੇ ਵਧੀਆ ਰੈਸਟੋਰੈਂਟ ਤੋਂ ਮੰਗਵਾਓ ਵੀ ਸਿਹਤ ਲਈ ਵੀ ਠੀਕ ਹੋਵੇ ਤੁਹਾਡੀ ਕੁਆਲਿਟੀ ਵੀ ਵਾਹਲੀ ਵਧੀਆ ਨਹੀਂ ਸੀਗੀ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਵੀ ਤੁਹਾਡੇ ਤੋਂ ਖਾਣਾ ਮੰਗਵਾ ਕੇ ਅਸੀਂ ਆਪਣੀ ਬੇਇੱਜ਼ਤੀ ਕਰਵਾਈਏ